ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਸਾਡੇ ਪਿੰਡ ਵਿੱਚ ਸ਼ਹਿਰਾਂ ਵਿੱਚ ਕਈ ਕਈ ਗੁਰ ਮੰਦਰ ਮੰਦਰ ਹਨ ਜਿਵੇਂ ਕਿ ਕਈ ਮੰਦਰ ਹਨ ਜਿੱਥੇ ਕਿ ਕਈ ਤਰ੍ਹਾਂ ਦਾ ਸਮਾਗਮ ਅਜ ਆਯੋਜਿਤ ਕੀਤਾ ਜਾਂਦਾ ਹੈ ਜਿਵੇਂ ਕਿ ਮੰਦਰਾਂ ਦੀ ਗੱਲ ਕਰੀਏ ਤਾਂ ਮੰਦਰ ਜਦੋਂ ਰਾਮਨੌਮੀ ਹੁੰਦੀ ਹੈ ਅਤੇ ਰਾਮਨੌਮੀ ਹੁੰਦੀ ਹੈ ਕਈ ਤਰ੍ਹਾਂ ਅਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਜਦੋਂ ਮਾਤਾ ਦੇ ਨਰਾਤੇ ਹੁੰਦੇ ਹਨ ਤਾਂ ਰਾਮ ਨੌਮੀ ਜਯੰਤੀ ਹਨੂੰਮਾਨ ਜੰਤੀ ਜਿਵੇਂ ਹਿੰਦੂ ਤਿਉਹਾਰ ਹੁੰਦੇ ਹਨ ਇਹਨਾਂ 'ਤੇ ਬਹੁਤ ਹੀ ਸਮਾਗਮ ਹੁੰਦੇ ਹਨ ਅਤੇ ਬਹੁਤ ਹੀ ਚਾਅ ਨਾਲ ਲੋਕ ਇਹਨਾਂ ਸਮਾਗਮਾਂ ਵਿੱਚ ਭਾਗ ਲੈ ਕੇ ਇਹਨਾਂ ਨੂੰ ਮਨਾਉਂਦੇ ਹਨ ਅਤੇ ਜੇਕਰ ਗੱਲ ਕਰੀਏ ਗੁਰਦੁਆਰਿਆਂ ਦੀ ਤਾਂ ਗੁਰਦੁਆਰਿਆਂ ਵਿੱਚ ਕਈ ਤਰ੍ਹਾਂ ਦੇ ਲੰਗਰ ਲੱਗਦੇ ਹਨ ਅਤੇ ਸਵੇਰੇ ਹਨੇਰੇ ਚਾਰ ਵਜੇ ਪ੍ਰਭਾਤ ਫੇਰੀਆਂ ਵੀ ਕੱਢੀਆਂ ਜਾਂਦੀਆਂ ਜਿਸ ਵਿੱਚ ਲੋਕਾਂ ਦੇ ਘਰ ਜਾ ਜਾ ਕੇ ਕੀਰਤਨ ਕੀਤਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਸਾ ਪਿੰਡ ਸਾਡੇ ਪਿੰਡ ਵਿੱਚ ਕਈ ਮਸਜਿਦਾਂ ਹਨ ਜਿਸ ਜਿਸ ਜਿੱਥੇ ਹਰ ਵੀਤ ਵੀਰਵਾਰ ਕਵਾਲੀਆਂ ਲਾਈਆਂ ਜਾਂਦੀਆਂ ਹਨ ਅਤੇ ਸਾਲ ਦੇ ਐਂਡ ਵਿੱਚ ਲੰਗਰ ਵੀ ਹੁੰਦਾ ਹੈ ਅਤੇ ਜਿਸ ਵਿੱਚ ਪਿੰਡ ਦੇ ਲੋਕ ਬਹੁਤ ਹੀ ਚਾਅ ਨਾਲ ਹਿੱਸਾ ਲੈਂਦੇ ਹਨ